ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਗਿਆਨੀ ਦੇ ਹੋਟਲ ਤੋਂ ਬੋਲਦੇ ਹੋ ਜੀ ਹਾਂਜੀ ਹਾਂਜੀ ਗੱਲ ਇਹ ਹੈ ਜੀ ਆਪਣੇ ਸੱਤ ਤਰੀਕ ਦਾ ਪ੍ਰੋਗਰਾਮ ਆ ਜੀ ਅਖੰਡ ਪਾਠ ਸਾਹਿਬ ਦੇ ਭੋਗ ਹਾਂਜੀ ਹਾਂਜੀ ਅਖੰਡ ਸਾਹਿਬ ਪਾਠ ਸਾਹਿਬ ਪ੍ਰਕਾਸ਼ ਨੇ ਹਾਂਜੀ ਨੌਂ ਤਰੀਕ ਦਾ ਭੋਗ ਹੈ ਜੀ ਉਹਦੇ ਲਈ ਸਾਨੂੰ ਮਠਿਆਈ ਵੀ ਚਾਹੀਦੀ ਹੈ ਜੀ ਅਤੇ ਪਕੌੜੇ ਵੀ ਚਾਹੀਦੇ ਨੇ ਅਤੇ ਨਾਲ ਸਾਨੂੰ ਹਲਵਾਈ ਵੀ ਚਾਹੀਦੇ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਵੇਰੇ ਆਉਂਦਿਆਂ ਨੂੰ ਮਠਿਆਈ ਜਿੱਦਾਂ ਗੁਲਾਬ ਜਾਮਨਾਂ ਰੱਖਣੀਆਂ ਨੇ ਅਤੇ ਨਾਲ ਵੈਜ ਪਕੌੜਾ ਮਿਕਸ ਪਕੌੜਾ ਹਾਂਜੀ ਅਤੇ ਚਾਹ ਦੇ ਨਾਲ ਜੀ ਹਾਂਜੀ ਬਾਅਦ ਦੇ ਵਿੱਚ ਰੋਟੀ ਦੇ ਨਾਲ ਦੋ ਸਬਜ਼ੀਆਂ ਨੇ ਜੀ ਇੱਕ ਮਿਕਸ ਵੈਜ ਕਰ ਲਵਾਂਗੇ ਜੀ ਅਤੇ ਨਾਲ ਇੱਕ ਮਟਰ ਪਨੀਰ ਅਤੇ ਨਾਲ ਖੀਰ ਕਰ ਲਵਾਂਗੇ ਹਾਂਜੀ ਹਾਂਜੀ ਹਾਂਜੀ ਤੁਸੀਂ ਇਹਨਾਂ ਦਾ ਰੇਟ ਦੱਸੋ ਜੀ ਤੁਹਾਡਾ ਕੀ ਰੇਟ ਬਣੇਗਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ ਚਲੋ ਠੀਕ ਹੈ ਜੀ ਉਹ ਤਾਂ ਬਾਕੀ ਰੇਟ ਥੋੜ੍ਹੇ ਜਿਹੇ ਤੁਹਾਡੇ ਉਹ 'ਚ ਥੋੜ੍ਹਾ ਬਹੁਤ ਡਿਸਕਾਊਂਟ ਵੀ ਕਰੋ ਜੀ ਸਾਨੂੰ ਹਾਂਜੀ ਹਾਂ ਅਸੀਂ ਕਿਹੜਾ ਪਹਿਲੀ ਵਾਰ ਆ ਰਹੇ ਹਾਂ ਤੁਹਾਡੇ ਕੋਲ ਫਿਰ ਤਾਂ ਇੱਦਾਂ ਹੋਵੇ ਨਾ ਵੀ ਅਸੀਂ ਪਹਿਲਾਂ ਵੀ ਪਹਿਲੀ ਵਾਰ ਆ ਰਹੇ ਹਾਂ ਤੁਹਾਡੇ ਕੋਲ ਅਤੇ ਤੁਸੀਂ ਰੇਟ ਉਹ ਹੀ ਲਗਾ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਸਾਈ ਪੱਕੀ ਕਰੋ ਸਾਡੀ ਫਿਰ ਸੱਤ ਤਰੀਕ ਦੀ ਅਤੇ ਅਸੀਂ ਬਾਕੀ ਇੱਕ ਵਾਰ ਸਾਈ ਦੇ ਰੁਪਈਏ ਦੇ ਦਿੰਦੇ ਹਾਂ ਤੁਹਾਨੂੰ ਪੰਜ ਸੱਤ ਹਜ਼ਾਰ ਰੁਪਇਆ ਅਤੇ ਬਾਕੀ ਦਾ ਜੋ ਵੀ ਬਣੇਗਾ ਉਹ ਤੁਹਾਨੂੰ ਬਾਅਦ 'ਚ ਦੇ ਦੇਵਾਂਗੇ ਹਾਂਜੀ ਹਾਂਜੀ ਸਚ ਇੱਕ ਗੱਲ ਹੋਰ ਸਾਨੂੰ ਰਿਸ਼ਤੇਦਾਰਾਂ ਨੂੰ ਡੱਬੇ ਵੀ ਦੇਣੇ ਨੇ ਉਹ ਪੰਜਾਹ ਕੁ ਡੱਬੇ ਲੱਡੂਆਂ ਦੇ ਲੱਗਣਗੇ ਉਹ ਸਾਨੂੰ ਪਹਿਲਾਂ ਚਾਹੀਦੇ ਨੇ ਜੀ ਸੱਤ ਤਰੀਕ ਨੂੰ ਹਾਂਜੀ ਉਹ ਪਹਿਲਾਂ ਦੇ ਦਿਓ ਬਾਕੀ ਦੀ ਜੋ ਵੀ ਮਠਿਆਈ ਉਹ ਭੋਗ 'ਤੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਓਕੇ ਧੰਨਵਾਦ